ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਮੋਹਿਤ ਗੱਲ ਕਰ ਰਿਹਾ ਜੀ ਜੋਤੀ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਭਾਅ ਜੀ ਮੈਂ ਨਾ ਕੋਈ ਤੁਹਾਨੂੰ ਡੇਢ ਕੁ ਘੰਟਾ ਪਹਿਲਾਂ ਕੁਛ ਸਮਾਨ ਔਡਰ ਕੀਤਾ ਸੀ ਜਿਸ 'ਚ ਅ ਪੰਜ ਛੇ ਵੈਜ ਆਈਟਮ ਸੀਗੀਆਂ ਮਾਂਹ ਮੱਖਣੀ ਸੀਗੀ ਅਤੇ ਸ਼ਾਹੀ ਪਨੀਰ ਸੀਗਾ ਬਟਰ ਨਾਨ ਸੀਗੇ ਅਤੇ ਕੁਛ ਡਰਿੰਕਸ ਵਗੈਰਾ ਸੀਗੀਆਂ ਜਿੱਦਾਂ ਕੋਕਟੇਲ ਕੋਕਟੇਲ ਵਗੈਰਾ ਅਤੇ ਉਸ 'ਚ ਤੁਹਾਨੂੰ ਮੈਂ ਨਾਲ ਕੁਛ ਸਨੈਕਸ ਵਗੈਰਾ ਜਿੱਦਾਂ ਸਟਾਰਟਸ ਵਗੈਰਾ ਸੀਗੇ ਆਪਣੇ ਤੁਹਾਨੂੰ ਯਾਦ ਹੀ ਹੋਣੇ ਪਨੀਰ ਪਨੀਰ ਵਗੈਰਾ ਸੀਗਾ ਕੁਛ ਪਨੀਰ ਦੀ ਸਬਜ਼ੀਆਂ ਸੀਗੀਆਂ ਅਤੇ ਉਹ ਨਾ ਤੁਸੀਂ ਕਿਹਾ ਸੀਗਾ ਵੀ ਇਹ ਸਭ ਕੁਛ ਰੈਡੀ ਕਰ ਕੇ ਤੁਸੀਂ ਇੱਕ ਘੰਟੇ ਤੱਕ ਮੈਨੂੰ ਪਹੁੰਚਾ ਦੋਗੇ ਅਤੇ ਤੁਸੀਂ ਜਿਸ ਡਿਲੀਵਰੀ ਬੁਆਏ ਦਾ ਮੈਨੂੰ ਨੰਬਰ ਦਿੱਤਾ ਸੀ ਮੈਨੂੰ ਅਤੇ ਮੈਂ ਉਹਨੂੰ ਪਿਛਲੇ ਪੰਦਰਾਂ ਮਿੰਟ ਤੋਂ ਕੌਲ ਕਰ ਰਿਹਾ ਹਾਂ ਅਤੇ ਸਾਡੇ ਘਰ ਗੈਸਟ ਆਏ ਹੋਏ ਆ ਅਤੇ ਲੰਚ ਦੀ ਵੇਟ ਹੋ ਰਹੀ ਹੈ ਅਤੇ ਮੈਂ ਉਸ ਬਸ ਪਸ ਉਹਨੂੰ ਬੰਦੇ ਨੂੰ ਫੋਨ ਕਰ ਰਿਹਾ ਹਾਂ ਅਤੇ ਉਹ ਮੇਰਾ ਫੋਨ ਨਹੀਂ ਚੱਕ ਰਿਹਾ ਅਤੇ ਤੁਸੀਂ ਦੱਸ ਸਕਦੇ ਹੋ ਵੀ ਉਹ ਬੰਦਾ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਅਤੇ ਉਹ ਕਿੱਥੇ ਖੜ੍ਹਾ ਕਿਉਂਕਿ ਗੈਸਟ ਨੇ ਵਾਪਸ ਆਪਣੇ ਦਿੱਲੀ ਜਾਣਾ ਅਤੇ ਉਹ ਲੇਟ ਹੋ ਰਹੇ ਨੇ ਅਤੇ ਇਸ ਕਰਕੇ ਮੈਨੂੰ ਦੱਸੋ ਵੀ ਤੁਹਾਡਾ ਬੰਦਾ ਕਿੱਥੇ ਪਹੁੰਚਿਆ ਜਾਂ ਨਿਕਲਿਆ ਜਾਂ ਨਹੀਂ ਨਿਕਲਿਆ ਕਿੱਥੇ ਫਸਿਆ ਹੋਇਆ ਹੈ ਟਰੈਫਿਕ 'ਚ ਫਸਿਆ ਕਿਤੇ ਹੋਰ ਫਸਿਆ ਹੋਇਆ ਹੈ ਕਿਉਂਕਿ ਉਹ ਫੋਨ ਵੀ ਨਹੀਂ ਚੱਕਦਾ ਪਿਆ ਜਾਂ ਤਾਂ ਉਹਨੂੰ ਕਹੋ ਵੀ ਮੇਰਾ ਫੋਨ ਚੱਕੇ ਅਤੇ ਜਾਂ ਤੁਸੀਂ ਉਹ ਨਾਲ ਗੱਲ ਕਰਕੇ ਅਤੇ ਜਿੰਨਾ ਜਲਦੀ ਹੋ ਸਕਦਾ ਮੇਰਾ ਔਡਰ ਡਿਲੀਵਰ ਕਰੋ ਅਤੇ ਹੋ ਸਕੇ ਜਲਦੀ ਤੋਂ ਜਲਦੀ ਇਹਨੂੰ ਮਤਲਬ ਤੁਸੀਂ ਪੂਰਾ ਕਰ ਦਿਓ ਕਿਉਂਕਿ ਗੈਸਟ ਨੇ ਵਾਪਸ ਦਿੱਲੀ ਜਾਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ